ਹੈਲੋ ਹਾਂਜੀ ਮੈਮ ਕੀ ਹਾਲ ਚਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਤੁਹਾਡਾ ਸਕੂਲ ਵਧੀਆ ਚੱਲ ਰਿਹਾ ਜੀ ਹਾਂਜੀ ਬਹੁਤ ਵਧੀਆ ਮੈਡਮ ਬਹੁਤ ਵਧੀਆ ਜੀ ਮੈਮ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਅਤੇ ਮੈਂ ਤੁਹਾਡੇ ਨਾਲ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੇਰੇ ਨਾ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਆ ਮੈਂ ਥੋੜ੍ਹਾ ਜਿਹਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹਾਂ ਮੈਨੂੰ ਕੁਛ ਕਲਾਸ ਦੇ ਵਿੱਚ ਪੜ੍ਹਾਉਂਦੇ ਹੋਏ ਕੁਝ ਸਮੱਸਿਆਵਾਂ ਆ ਰਹੀਆਂ ਨੇ ਅਤੇ ਮੈਂ ਤੁਹਾਡੇ ਨਾਲ ਸਾਂਝੀਆ ਕਰਨਾ ਚਾਹੁੰਦੀ ਹਾਂ ਤਾਂ ਕਿ ਕੋਈ ਮਿਲਵਾਂ ਹੱਲ ਆਪਾਂ ਕੱਢ ਸਕੀਏ ਉਸ ਬੱਚੇ ਨੂੰ ਅੱਗੇ ਲੈ ਕੇ ਜਾਣ ਦਾ ਹੁੰਦਾ ਕੀ ਹੈ ਕਿ ਉਹ ਜਿਹੜਾ ਬੱਚਾ ਨਾ ਉਹ ਜਦੋਂ ਆਪਾਂ ਵੈਸੇ ਅਦਰਵਾਈਜ਼ ਉਹਦੇ ਨਾਲ ਗੱਲ ਕਰੋ ਵੱਖਰੇ ਤੌਰ 'ਤੇ ਗੱਲ ਕਰੋ ਬੜਾ ਵਧੀਆ ਰਿਸਪੋਂਸ ਦਿੰਦਾ ਹੈ ਉਹਨੂੰ ਗੱਲ ਵੀ ਕਰਨੀ ਆਉਂਦੀ ਹੈ ਉਹਦੀ ਯਾਦ ਸ਼ਕਤੀ ਵੀ ਹੈ ਪਰ ਜਦੋਂ ਜਮਾਤ ਦੇ ਵਿੱਚ ਪੜ੍ਹਾ ਰਹੇ ਹੁੰਦੇ ਹਾਂ ਨਾ ਉਹ ਜਿਵੇਂ ਡਰਿਆ ਵਿਆ ਹੋਵੇ ਜਾਂ ਇਹ ਕਹਿ ਲਓ ਜਿਸ ਤਰ੍ਹਾਂ ਆਪਾਂ ਅੱਗੇ ਪੰਜਾਬੀ 'ਚ ਨਹੀਂ ਕਹਿੰਦੇ ਹੁੰਦੇ ਸੀ ਵੀ ਭੋਂਦੂ ਜਿਹੇ ਹਾਂ ਮਤਲਬ ਹਾਂ ਸਹਿਮਿਆ ਜਿਹਾ ਮਤਲਬ ਉਹ ਇਕਦਮ ਦੇਖ ਤਾਂ ਰਿਹਾ ਹੁੰਦਾ ਪਰ ਉਹਨੂੰ ਜਿਵੇਂ ਕੁਛ ਪੱਲੇ ਹੀ ਨਹੀਂ ਪੈ ਰਿਹਾ ਹੁੰਦਾ ਅਤੇ ਬਸ ਜੇ ਉਹਨੂੰ ਇੱਕੋ ਦਮ ਪੁੱਛੋ ਕੋਈ ਗੱਲ ਤਾਂ ਉਹ ਬੜਾ ਡਰ ਕੇ ਹਾਂਜੀ ਬੜੀ ਮਤਲਬ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਮਤਲਬ ਦਿਮਾਗੀ ਤੌਰ 'ਤੇ ਜਮਾਤ ਦੇ ਵਿੱਚ ਨਹੀਂ ਹੁੰਦਾ ਵੈਸੇ ਜਮਾਤ ਦੇ ਵਿੱਚ ਹੁੰਦਾ ਜੇ ਸਿਰਫ਼ ਅਤੇ ਸਿਰਫ਼ ਉਹਦੇ ਇਕੱਲੇ ਨਾਲ ਗੱਲਬਾਤ ਕਰੋ ਫਿਰ ਉਹ ਤੁਹਾਨੂੰ ਅਸਲੀ ਜਿਹੜੀ ਹੈ ਆਪਣੀ ਗੱਲਬਾਤ ਦੱਸ ਪਾਉਂਦਾ ਕੀ ਮਤਲਬ ਮੈਂ ਕੀ ਇਸਦਾ ਹੱਲ ਲੱਭਾਂ ਮੈਡਮ ਜੀ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹੂੰ ਹੂੰ ਹੂੰ ਹੂੰ ਹਾਂਜੀ ਨਹੀਂ ਮੈਂ ਉਹ ਤਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਮੈਂ ਉਹਨੂੰ ਕਈ ਖੇਡ ਵਿਧੀਆ ਰਾਹੀਂ ਵੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ ਗੱਲਾਂ ਵੀ ਉਹਦੇ ਨਾਲ ਕਰਦੀ ਹਾਂ ਪਰ ਇਹ ਤੁਹਾਡੀ ਗੱਲ ਠੀਕ ਹੈ ਹਾਜੀ ਠੀਕ ਹੈ ਜੀ ਹੂੰ ਹੂੰ ਹੂੰ ਬਿਲਕੁਲ ਜੀ ਬਿਲਕੁਲ ਹਾਂਜੀ ਜੀ ਬਿਲਕੁਲ ਜੀ

ਹਾਂ ਹਾਂਜੀ ਹਾਂਜੀ ਹਾਂਜੀ ਨਹੀਂ ਉਹ ਕਲਾਸ ਟੀਚਰਜ ਨਾਲ ਤਾਂ ਮੈਂ ਗੱਲਾਂ ਕੀਤੀਆਂ ਹੀ ਸੀ ਪਰ ਉਹ ਕੋਈ ਬਹੁਤਾ ਰਿਸਪੋਂਸ ਨਹੀਂ ਦੇ ਰਹੇ ਉਹਨਾਂ ਨੂੰ ਸਭ ਇਹ ਹੀ ਹੁੰਦਾ ਬਸ ਠੀਕ ਹੈ ਜੀ ਪਰ ਮੈਨੂੰ ਮੇਰੀ ਚਿੰਤਾ ਸੀਗੀ ਤਾਂ ਮੈਨੂੰ ਪਤਾ ਕਿ ਤੁਸੀਂ ਵੀ ਬੱਚਿਆਂ ਦੀ ਜਿਹੜੀ ਮਨੋਵਿਗਿਆਨਿਕ 'ਤੇ ਅੱਛਾ ਸੋਚਦੇ ਹੋ ਹੈ ਨਾ ਇਸ ਲਈ ਮੈਂ ਤੁਹਾਡੇ ਨਾਲ ਇਸ ਗੱਲਬਾਤ ਨੂੰ ਜਿਹੜਾ ਸਾਂਝਾ ਕਰਨਾ ਵਧੀਆ ਸਮਝਿਆ ਹਾਂਜੀ ਹਾਂਜੀ ਉਹ ਵੀ ਦੱਸ ਸਕਦਾ ਹੈ ਨਾ ਹੂੰ ਹੂੰ ਹੂੰ ਹੂੰ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜਾਂ ਘਰੋਂ ਕਿਸੇ ਗੱਲ ਤੋਂ ਡਰਿਆ ਹੋਇਆ ਹੈ ਨਾ ਤਾਂ ਉਹਦਾ ਦਿਮਾਗ ਉਸ ਟਾਈਮ ਉਹ ਸੋਚਣ ਲੱਗ ਜਾਂਦਾ

ਹਾਂ ਜੀ ਬਿਲਕੁਲ ਜਾਂ ਉਹਦੇ ਘਰ ਵੀ ਵਿਜਿਟ ਕੀਤਾ ਜਾ ਸਕਦਾ ਹੈ ਨਾ ਖੁਦ ਹੀ ਉਸ ਦੇ ਘਰ ਜਾਇਆ ਜਾਵੇ ਹਾਂ ਇਹ ਹੀ ਗੱਲ ਮੈਂ ਸੋਚ ਰਹੀ ਸੀ ਨਾ ਕਿ ਜੇ ਵਾਕਿਆ ਹੀ ਉਹ ਬੱਚਾ ਮਤਲਬ ਆਪਾਂ ਕਹਿ ਲਈਏ ਕਿ ਪੜ੍ਹਾਈ ਦੇ ਵਿੱਚ ਉਹਦੀ ਸਮਝ ਘੱਟ ਹੈ ਜਾਂ ਉਹਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ ਪਰ ਜਦੋਂ ਆਪਾਂ ਇਕੱਲੇ ਗੱਲ ਕਰਦੇ ਹਾਂ ਉਦੋਂ ਵਧੀਆ ਜਵਾਬ ਦਿੰਦਾ ਤਾਂ ਇਹਦਾ ਮਤਲਬ ਉਹਨੂੰ ਸਮਝ ਤਾਂ ਆ ਰਹੀ ਹੈ ਨਾ ਹਾਂ ਹਾਂਜੀ ਹਾਂ ਉਹਨੂੰ ਆਪਣੀ ਗੱਲਬਾਤ ਕਰਨ ਲਈ ਝਿਜਕ ਹੋਵੇ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਮਤਲਬ ਮੈਂ ਸੋਚ ਰਹੀ ਸੀ ਪਰ ਕਿਸੇ ਫੈਸਲੇ 'ਤੇ ਨਹੀਂ ਸੀ ਪਹੁੰਚ ਪਾ ਰਹੀ ਪਰ ਤੁਹਾਡੀ ਗੱਲ ਨਾਲ ਮੇਰੀ ਗੱਲ ਨੂੰ ਇੱਕ ਠੋਸ ਆਧਾਰ ਮਿਲ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਡੇ ਤੋਂ ਇਹ ਹੀ ਉਮੀਦ ਸੀ ਮੈਨੂੰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਅਤੇ ਰੱਬ ਕਰੇ ਜਲਦੀ ਉਸ ਬੱਚੇ ਦੀ ਸਮੱਸਿਆ ਹੱਲ ਹੋਵੇ ਤਾਂ ਮੈਂ ਤੁਹਾਨੂੰ ਫਿਰ ਦੁਬਾਰਾ ਕੋਲ ਕਰੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਜੀ ਇੱਕ ਵਾਰ ਫਿਰ ਧੰਨਵਾਦ ਜੀ ਤੁਹਾਡਾ ਓਕੇ ਓਕੇ ਜੀ